ਭੰਗੜਾ ਪੰਜਾਬ ਦੀ ਸ਼ਾਨ ਹੈ ਭੰਗੜੇ ਦੇ ਬਹੁਤ ਸਾਰੇ ਸਟੈਪ ਹਨ ਜਿਹਨਾਂ ਵਿੱਚੋਂ ਇੱਕ ਸਟੈਪ ਝੁੰਮਰ ਹੈ ਜਿਸ ਵਿੱਚ ਗੋਲ ਗੋਲ ਘੁੰਮ ਕੇ ਭੰਗੜਾ ਪਾਇਆ ਜਾਂਦਾ ਹੈ ਦੂਸਰਾ ਸਟੈਪ ਲੁੱਡੀ ਹੈ ਜਿਸ ਵਿੱਚ ਇੱਕ ਪੈਰ ਅੱਗੇ ਇੱਕ ਪੈਰ ਪਿੱਛੇ ਕਰਕੇ ਭੰਗੜਾ ਪਾਇਆ ਜਾਂਦਾ ਹੈ ਭੰਗੜੇ ਨੂੰ ਹੋਰ ਵੀ ਬਹੁਤ ਤਰ੍ਹਾਂ ਨਾਲ ਪਾਇਆ ਜਾਂਦਾ ਹੈ ਢੋਲ 'ਤੇ ਵੀ ਭੰਗੜਾ ਪਾਇਆ ਜਾਂਦਾ ਹੈ ਪੰਜਾਬੀ ਸੱਭਿਆਚਾਰ ਦੇ ਜ਼ੋਰਜ ਜ਼ੋਰਦਾਰ ਅਤੇ ਜਸ਼ਨ ਵਾਲੇ ਸੁਭਾਅ ਵਿੱਚ ਭੰਗੜਾ ਬਹੁਤ ਯੋਗਦਾਨ ਪਾਉਂਦਾ ਹੈ ਜਿਵੇਂ ਕਿ ਵਿਆਹ ਸ਼ਾਦੀਆਂ ਵਿੱਚ ਭੰਗੜਾ ਪਾਉਂਦੇ ਨੇ ਲੋਕ ਅਤੇ ਖਾਸ ਕਰਕੇ ਜਦੋਂ ਪੰਜਾਬ ਵਿੱਚ ਕੋਈ ਵਿਆਹ ਹੁੰਦਾ ਹੈ ਕਿਸੇ ਦੇ ਘਰ ਵਿੱਚ ਤਾਂ ਭੰਗੜਾ ਪਾ ਕੇ ਪੰਜਾਬੀ ਆਪਣੀ ਆਪਣਾ ਮਨ ਪਰਚਾਵਾ ਕਰਦੇ ਹਨ ਭੰਗੜਾ ਪਾ ਕੇ ਪੰਜਾਬੀ ਬਹੁਤ ਖੁਸ਼ ਹੁੰਦੇ ਹਨ ਭੰਗੜੇ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਪੰਜਾਬ ਵਿੱਚ ਧੰਨਵਾਦ ਜੀ